ਹੈਲੋ ਸਤਿ ਸ਼੍ਰੀ ਅਕਾਲ ਜੀ ਓਲਾ ਕੰਪਨੀ ਤੋਂ ਬੋਲਦੇ ਪਏ ਹੋ ਹਾਂਜੀ ਸਰ ਮੈਂ ਨਾ ਇੱਕ ਕੈਬ ਬੁੱਕ ਕੀਤੀ ਸੀਗੀ ਔਰ ਮੈਂ ਇੱਕ ਫੰਕਸ਼ਨ ਅਟੈਂਡ ਕਰਨਾ ਸੀਗਾ ਔਰ ਮੈਨੂੰ ਜਲਦੀ ਵੀ ਸੀ ਸੋ ਇਹ ਬੰਦਾ ਕੈਬ ਵਾਲਾ ਤਾਂ ਟਾਈਮ ਨਾਲ ਹੀ ਆ ਗਿਆ ਸੀਗਾ ਔਰ ਰਸਤਾ ਕਾਫੀ ਦੂਰ ਸੀਗਾ ਅਤੇ ਸੋ ਅਸੀਂ ਜਦੋਂ ਜਾ ਗਏ ਪਹੁੰਚੇ ਉੱਥੇ ਮਤਲਬ ਜਿੱਥੇ ਮੈਂ ਫੰਕਸ਼ਨ ਅਟੈਂਡ ਕਰਨਾ ਸੀਗਾ ਤਾਂ ਮੇਰੇ ਕੋਲ ਉਹ ਦੋ ਪਰਸ ਸੀਗੇ ਔਰ ਇੱਕ ਪਰਸ ਮੈਂ ਜਲਦਬਾਜ਼ੀ ਦੇ ਵਿੱਚ ਗੱਡੀ ਦੇ ਵਿੱਚ ਹੀ ਭੁੱਲ ਗਈ ਸੀ ਔਰ ਇੱਕ ਪਰਸ ਮੈਂ ਲਿਆ ਜਦੋਂ ਮੈਂ ਗੇਟ ਦੇ ਐਂਟਰੀ ਕੀਤਾ ਤਾਂ ਮੈਨੂੰ ਉਦੋਂ ਪਤਾ ਲੱਗਿਆ ਕਿ ਮੇਰਾ ਇੱਕ ਪਰਸ ਜਿਹੜਾ ਵਾ ਉਹ ਜਿਹੜਾ ਕੈਬ ਦੇ ਵਿੱਚ ਰਹਿ ਗਿਆ ਹੈ ਔਰ ਮੈਂ ਵਾਪਸ ਆਪਣੇ ਦੂਜੇ ਪਰਸ 'ਚੋਂ ਫੋਨ ਕੱਢ ਕੇ ਉਹਨੂੰ ਮਤਲਬ ਕਿ ਕੋਸ਼ਿਸ਼ ਕੀਤੀ ਰੋਕਣ ਦੀ ਬਟ ਉਹਨਾਂ ਨੇ ਨਾ ਮੇਰਾ ਫੋਨ ਰਸੀਵ ਨਹੀਂ ਕੀਤਾ ਔਰ ਮੇਰੀ ਰਿਕੁਐਸਟ ਹੈ ਤੁਹਾਡੇ ਅੱਗੇ ਕਿ ਇਹ ਜਿਹੜੀ ਵੀ ਕੈਬ ਸੀਗੀ ਉਹ ਤਾਂ ਤੁਹਾਨੂੰ ਪਤਾ ਹੀ ਹੈ ਕਿਸ ਨੰਬਰ ਤੋਂ ਸੀਗੀ ਸੋ ਉਹਨਾਂ ਨੂੰ ਪਲੀਜ਼ ਤੁਸੀਂ ਫੋਨ ਕਰਕੇ ਅਤੇ ਮੇਰਾ ਪਰਸ ਜਿਹੜਾ ਆ ਉਹ ਮੈਨੂੰ ਵਾਪਸ ਪਹੁੰਚਾਉਣ ਦੀ ਕੋਸ਼ਿਸ਼ ਜ਼ਰੂਰ ਕਰਿਓ ਕਿਉਂਕਿ ਮੈਂ ਜਿੱਥੇ ਉਹ ਮੈਨੂੰ ਛੱਡ ਕੇ ਗਏ ਨੇ ਮੈਂ ਉੱਥੇ ਹੀ ਵੇਟ ਕਰਾਂਗੀ ਔਰ ਪਰਸ ਦੇ ਵਿੱਚ ਮੇਰੇ ਜ਼ਰੂਰੀ ਕਾਗਜ਼ਾਤ ਸੀਗੇ ਕੁਛ ਡੋਕੂਮੈਂਟ ਸੀਗੇ ਉਹ ਮੈਨੂੰ ਜ਼ਰੂਰ ਚਾਹੀਦੇ ਨੇ ਔਰ ਰਹੀ ਗੱਲ ਤੁਹਾਡੇ ਡਰਾਈਵਰ ਦੀ ਉਹ ਬਹੁਤ ਅੱਛਾ ਸੀਗਾ ਕਿਉਂਕਿ ਰਸਤੇ ਵਿੱਚ ਅਸੀਂ ਗੱਲਬਾਤ ਕਰਦੇ ਰਹੇ ਹਾਂ ਬਹੁਤ ਅੱਛੇ ਵਿਚਾਰ ਸੀਗੇ ਉਹਦੇ ਮੈਨੂੰ ਲੱਗਦਾ ਨਹੀਂ ਹੈ ਕਿ ਉਹ ਇਸ ਤਰ੍ਹਾਂ ਮਤਲਬ ਕਿ ਮਿਸਗਾਈਡ ਕਰੇਗਾ ਜਾਂ ਧੋਖਾ ਦੇਵੇਗਾ ਅਤੇ ਸੋ ਮੇਰੀ ਰਿਕੁਐਸਟ ਹੈ ਕਿ ਪਲੀਜ਼ ਉਹਨਾਂ ਨੂੰ ਫੋਨ ਕਰਕੇ ਅਤੇ ਮੇਰਾ ਸਮਾਨ ਜਿਹੜਾ ਹੈ ਜਲਦੀ ਤੋਂ ਜਲਦੀ ਮੇਰੇ ਤੱਕ ਪਹੁੰਚਾਉ ਕਿਉਂਕਿ ਮੈਨੂੰ ਬਹੁਤ ਜ਼ਰੂਰੀ ਸੀਗਾ ਫੰਕਸ਼ਨ ਤੋਂ ਬਾਅਦ ਮੈਂ ਹੋਰ ਵੀ ਇੱਕ ਜਗ੍ਹਾ 'ਤੇ ਜਾਣਾ ਸੀਗਾ ਸੋ ਉਹ ਵੀ ਮੇਰੀ ਅਪੋਆਇੰਟਮੈਂਟ ਫਿਰ ਜਿਹੜੀ ਆ ਉਹ ਫੇਲ ਹੋ ਜਾਣੀ ਹੈ ਸੋ ਮੇਰੀ ਰਿਕੁਐਸਟ ਹੈ ਕਿ ਪਲੀਜ਼ ਤੁਸੀਂ ਉਸ ਆਪਣੇ ਇੰਪਲੋਇਡ ਨੂੰ ਕਹੋ ਕਿ ਉਹ ਮੇਰੇ ਤੱਕ ਪਹੁੰਚਣ ਦੀ ਅਪਰੋਚ ਕਰਨ ਅਤੇ ਪਲੀਜ਼ ਮੇਰਾ ਸਮਾਨ ਜਿਹੜਾ ਆ ਮੈਨੂੰ ਵਾਪਸ ਦੇਣ ਸੋ ਥੈਂਕ ਯੂ ਸੋ ਮੱਚ